ਸਾਨੂੰ ਡੇਂਗੂ ਬੁਖਾਰ ਅਤੇ ਮਲੇਰੀਆ ਵਰਗੇ ਮੱਛਰਾਂ ਤੋਂ ਹੋਣ ਵਾਲੇ ਬਿਮਾਰੀਆਂ ਲਈ ਬਚਣ ਲਈ ਸਭ ਤੋਂ ਪਹਿਲਾਂ ਤਾਂ ਆਪਣੇ ਆਸ ਪਾਸ ਖੜਾ ਪਾਣੀ ਹੈ ਉਸ ਨੂੰ ਖੜਾ ਨਹੀਂ ਹੋਣ ਦੇਣਾ ਕਿਉਂਕਿ ਪਾਣੀ ਜੇ ਖੜਾ ਹੈ ਉਹਦੇ ਵਿੱਚ ਮੱਛਰ ਪਣਪਣਗੇ ਹੀ ਸਭ ਤੋਂ ਪਹਿਲਾਂ ਤਾਂ ਸਾਨੂੰ ਉਹਨੂੰ ਉਹਨੂੰ ਸਾਫ ਜਗ੍ਹਾ ਨੂੰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਜੇ ਮੱਛਰ ਹੋ ਵੀ ਜਾਣ ਤਾਂ ਸਾਨੂੰ ਬਹੁਤ ਅੱਛੀ ਤਰ੍ਹਾਂ ਆਪਣੇ ਆਲੇ ਦੁਆਲੇ ਮੱਛਰ ਦਾ ਸਪਰੇ ਕਰਾਉਣਾ ਚਾਹੀਦਾ ਹੈ ਕਿ ਜੋ ਗੋਰਮੈਂਟ ਫਰੀ ਕਰ ਦਿੰਦੀ ਹੈ ਅਤੇ ਫਿਰ ਆਪਣੇ ਆਪਣੇ ਐਂਡ 'ਤੇ ਅਸੀਂ ਇਹ ਕਰ ਸਕਦੇ ਹਾਂ ਕਿ ਜਿਵੇਂ ਆਪਣੇ ਆਡੋਮਾਸ ਆਉਂਦੀ ਹੈ ਉਹ ਬੱਚਿਆਂ ਨੂੰ ਅਤੇ ਆਪਣੇ ਸਰੀਰ 'ਤੇ ਅਸੀਂ ਲਾ ਕੇ ਹੀ ਬਾਹਰ ਜਾਈਏ ਜਾਂ ਜਿਹੜੇ ਆਪਣੇ ਅੰਦਰ ਲਗਾਉਣ ਵਾਲੇ ਯੰਤਰ ਹੁੰਦੇ ਨੇ ਉਹਨਾਂ ਨੂੰ ਆਪਾਂ ਬਿਜਲੀ 'ਤੇ ਲਗਾ ਕੇ ਆਪਾਂ ਉਹਨਾਂ ਨੂੰ ਮੱਛਰਾਂ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਹਾਂ ਅਤੇ ਜਿਹੜੇ ਵੀ ਸਾਡੇ ਈਮਿਊਨਟੀ ਬੂਸਟਰਸ ਆਉਂਦੇ ਆ ਦਵਾਈਆਂ ਹੁੰਦੀਆਂ ਨੇ ਉਹ ਜਿਹੜੀ ਸਾਨੂੰ ਇਸ ਲੜਨ ਇਸ ਬਿਮਾਰੀ ਤੋਂ ਲੜਨ ਦੀ ਸ਼ਕਤੀ ਦੇਣ ਜੇ ਸਾਨੂੰ ਗਲਤੀ ਨਾਲ ਮੱਛਰ ਕੱਟ ਵੀ ਜਾਂਦਾ ਹੈ ਤਾਂ ਸਾਨੂੰ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਧੰਨਵਾਦ